ਮੈ ਜਿਸ ਰਾਜ ਵਿੱਚ ਵੀ ਰਹਿੰਦੀ ਹਾਂ ਜਿਸ ਏਰੀਏ ਵਿੱਚ ਵੀ ਰਹਿੰਦੀ ਹਾਂ ਉੱਥੇ ਆਵਾਜਾਈ ਦੇ ਸਾਰੇ ਸਾਧਨ ਮੌਜੂਦ ਨੇ ਬੱਸ ਟਰੇਨ ਐਰੋਪਲੇਨ ਤੋਂ ਲੈ ਕੇ ਹਰ ਇੱਕ ਤਰ੍ਹਾਂ ਦੀ ਯਾਤਰਾ ਜਿਵੇਂ ਦੀ ਵੀ ਕੋਈ ਕਰਨੀ ਪਸੰਦ ਕਰਦਾ ਕਰ ਸਕਦਾ ਹੈ ਕੋਈ ਵੀ ਦਿੱਕਤ ਵਾਲ਼ੀ ਗੱਲ ਨਹੀਂ ਹੈ